ਮੈਨੂੰ ਇੱਥੇ ਬਹੁਤ ਵਧੀਆ ਕੰਮ ਲੱਗ ਰਿਹਾ ਮੈਂ ਹਾਊਸਪਿਕਿੰਗ ਦਾ ਕੰਮ ਕਰ ਰਿਹਾ ਅਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਅਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਅਤੇ ਨਾ ਮੈਨੂੰ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਆ ਕੰਮ ਕਰਨੇ ਦੇ ਵਿੱਚ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਿਹਾ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ